ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਬ੍ਰਹਿਮੰਡ ਆਪਣੇ ਆਪ ਵਿੱਚ ਇੱਕ ਬਹੁਤ ਵੱਡਾ ਰਹੱਸ ਹੈ ਪਰ ਹਰ ਵਾਰ ਬ੍ਰਹਿਮੰਡ ਨਾਲ ਜੁੜੇ ਰਹੱਸਮਈ ਕਿੱਸੇ ਸੁਣਨ ਨੂੰ ਮਿਲਦੇ ਹਨ ਨਵੀਂ ਨਵੀਂ ਖੋਜਾਂ ਤੋਂ ਬਹੁਤ ਸਾਰੇ ਤੱਤ ਸਾਬਤ ਹੁੰਦੇ ਹਨ ਪਰ ਉਹਨਾਂ ਦੇ ਨਾਲ ਹੀ ਨਵੇਂ ਰਹੱਸ ਵੀ ਸਾਹਮਣੇ ਆਉਂਦੇ ਹਨ ਮੈਨੂੰ ਸਭ ਤੋਂ ਜ਼ਿਆਦਾ ਮਜ਼ਾ ਬਲੈਕ ਹੋਲ ਬਾਰੇ ਜਾਣਨ ਵਿੱਚ ਆਉਂਦਾ ਹੈ ਕਿਵੇਂ ਉਹ ਬਦਲਦਾ ਹੈ ਅਤੇ ਕਿਵੇਂ ਆਪਣੇ ਸਾਹਮਣੇ ਆਉਣ ਵਾਲੀ ਹਰ ਚੀਜ਼ ਨੂੰ ਆਪਣੇ ਅੰਦਰ ਸਮਾ ਲੈਂਦਾ ਹੈ ਇੱਥੋਂ ਤੱਕ ਕਿ ਰੋਸ਼ਨੀ ਵੀ ਬਲੈਕ ਹੋਲ ਦੇ ਅੰਦਰ ਜਾ ਕੇ ਆਪਣੀ ਪਹਿਚਾਣ ਖੋ ਦਿੰਦੀ ਹੈ ਬਲੈਕ ਹੋਲ ਤੋਂ ਇਲਾਵਾ ਗ੍ਰਹਿਆਂ ਬਾਰੇ ਜਾਣਨਾ ਵੀ ਚੰਗਾ ਲੱਗਦਾ ਹੈ ਨਵੇਂ ਨਵੇਂ ਗ੍ਰਹਿਆਂ ਦੀ ਹੋ ਰਹੀ ਤਲਾਸ਼ ਅਤੇ ਉਹਨਾਂ 'ਤੇ ਜੀਵਨ ਦੀ ਖੋਜ ਬਹੁਤ ਦਿਲਚਸਪ ਵਿਸ਼ੇ ਹਨ ਤਾਰਿਆਂ ਬਾਰੇ ਜਾਣਕਾ ਜਾਣਕਾਰੀ ਪ੍ਰਾਪਤ ਕਰਨਾ ਵੀ ਇੱਕ ਦਿਲਚਸਪ ਵਿਸ਼ਾ ਹੈ ਧਰਤੀ ਤੋਂ ਦੇਖਣ ਨੂੰ ਤਾਂ ਇਹ ਬਹੁਤ ਛੋਟੇ ਲੱਗਦੇ ਹਨ ਪਰ ਅਸਲ ਵਿੱਚ ਇਹ ਸੂਰਜ ਤੋਂ ਵੀ ਕਈ ਗੁਣਾ ਵੱਡੇ ਹੁੰਦੇ ਹਨ ਅਤੇ ਇਹ ਜਦ ਰਾਤ ਨੂੰ ਚਮਕਦੇ ਹਨ ਤਾਂ ਬਹੁਤ ਹੀ ਸੋਹਣੇ ਲੱਗਦੇ ਹਨ